ਹੈਲੋ ਹਾਂਜੀ ਭਾਅ ਜੀ ਉਬਰ ਦੇ ਦਫ਼ਤਰ ਤੋਂ ਬੋਲ ਰਹੇ ਹੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਮੈਂ ਨਾ ਇੱਕ ਕੈਬ ਡਰਾਇਵਰ ਅ ਹਾਂਜੀ ਹਾਂਜੀ ਕੈਬ ਡਰਾਇਵਰ ਦੀ ਸ਼ਿਕਾਇਤ ਕਰਨੀ ਸੀ ਗੱਡੀ ਨੰਬਰ ਸੀ ਐਚ ਜ਼ੀਰੋ ਵਨ ਏ ਵੀ ਦੋ ਸੌ ਛਿਅੱਤਰ ਹਾਂਜੀ ਡਰਾਇਵਰ ਦਾ ਨਾਮ ਕਮਲਜੀਤ ਸਿੰਘ ਸੀ ਮੈਂ ਤੁਹਾਡੇ ਐਪ ਤੋਂ ਹੀ ਇਹਦੀ ਬੁਕਿੰਗ ਕੀਤੀ ਸੀ ਪਿਛਲੇ ਐਤਵਾਰ ਹੀ ਏਅਰਪੋਰਟ ਤੋਂ ਆਪਣੇ ਘਰ ਆਉਣ ਵਾਸਤੇ ਹਾਂਜੀ ਮੈਂ ਅੱਧ ਘੰਟਾ ਏਅਰਪੋਰਟ 'ਤੇ ਖੜ੍ਹਾ ਰਿਹਾ ਪਰ ਡਰਾਇਵਰ ਨਹੀਂ ਆਇਆ ਨਾ ਗੱਡੀ ਆਈ ਇੰਨੀ ਅਣਗਹਿਲੀ ਤੁਹਾਡੇ ਡਰਾਇਵਰ ਦੀ ਮੈਂ ਪੈਸੇ ਪੇਮੈਂਟ ਕਰਤੀ ਸੀ ਤੁਸੀਂ ਮੈਨੂੰ ਉਹ ਪੈਸੇ ਰਿਫੰਡ ਕਰ ਦਿਉ ਅਤੇ ਆਪਣਾ ਅਗਾਂਹ ਵਾਸਤੇ ਡਰਾਇਵਰ ਨੂੰ ਤਾੜਿਓ ਜ਼ਰੂਰ